ਪ੍ਰੋਡਕਟ ਦੇ ਵਿੱਚ ਮੈਂ ਇੱਕ ਨਾਵਲ ਮੰਗਵਾਇਆ ਸੀ ਜੋ ਕਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਮੰਗਵਾਇਆ ਸੀ ਜਿਹਦੇ ਵਿੱਚ ਵੀ ਇਹ ਜਿਹੜਾ ਨਾਵਲ ਸੀ ਮੈਂ ਕਿਸੇ ਆਪਦੇ ਦੋਸਤ ਨੂੰ ਤੋਹਫੇ ਦੇ ਵਜੋਂ ਦੇਣਾ ਸੀ ਇਹ ਨਾਵਲ ਨਾਨਕ ਸਿੰਘ ਦਾ ਸੀਗਾ ਪਵਿੱਤਰ ਪਾਪੀ ਜੋ ਕਿ ਜਦੋਂ ਮੈਂ ਇਹ ਇੱਕੋ ਦਮ ਵੀ ਆਪਾਂ ਨੂੰ ਖੁਸ਼ੀ ਜਿਹੀ ਹੁੰਦੀ ਆ ਮੈਂ ਇੱਕੋ ਦਮ ਪਾਰਸਲ ਖੋਲ੍ਹਿਆ ਤਾਂ ਵੀ ਮੈਨੂੰ ਵੀ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਇੱਕ ਖੁਸ਼ੀ ਤਾਂ ਜ਼ਿਆਦਾ ਹੋਈ ਕਿਉਂਕਿ ਉਹ ਥੋੜ੍ਹੇ ਜਿਹੇ ਦਿਨਾਂ 'ਚ ਹੀ ਆ ਗਿਆ ਸੀਗਾ ਵੀ ਪੰਜ ਚਾਰ ਦਿਨਾਂ 'ਚ ਹੀ ਆ ਗਿਆ ਸੀਗਾ ਅਤੇ ਉਹ ਦੋਸਤ ਦਾ ਜਨਮਦਿਨ ਸੀ ਮੈਨੂੰ ਐਂ ਸੀ ਜਨਮਦਿਨ ਦੀ ਤਰੀਕ ਤੋਂ ਬਾਅਦ ਨਾ ਆਵੇ ਉਹਦੇ ਤੋਂ ਪਹਿਲਾਂ ਹੀ ਆ ਗਿਆ ਸੀ ਇਹ ਅਤੇ ਇਸ ਤੋਂ ਬਾਅਦ ਜਦੋਂ ਮੈਂ ਉਹ ਖੋਲ੍ਹਿਆ ਵੀ ਮੈਨੂੰ ਵਧੀਆ ਲੱਗਿਆ ਉਹ ਬਹੁਤ ਹੀ ਸੋਹਣਾ ਲੱਗਿਆ ਅਤੇ ਬਹੁਤ ਹੀ ਖੁਸ਼ੀ ਹੋਈ ਅਤੇ ਜਦੋਂ ਉਹਦੇ ਮੈਂ ਪੇਜ ਦੇਖੇ ਉਹਦੇ ਪੇਜਾਂ ਦੀ ਜਿਹੜੀ ਕੁਆਲਿਟੀ ਸੀ ਉਹ ਵੀ ਬਹੁਤ ਚੰਗੀ ਸੀ ਅਤੇ ਮੈਂ ਇਹਦੇ ਨਾਲ ਵੀ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਫਿਰ ਮੈਂ ਉਹਨਾਂ ਨੂੰ ਉਹ ਗਿਫਟ ਦਿੱਤਾ